ਸਤਿ ਸ਼੍ਰੀ ਅਕਾਲ ਮੇਰਾ ਨਾਮ ਅਰਮਾਨਦੀਪ ਸਿੰਘ ਹੈ ਮੈਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹਾਂ ਮੈਂ ਭੰਗੜੇ ਵਿੱਚ ਬਹੁਤ ਹੀ ਵਧੀਆ ਸੀ ਅਤੇ ਮੈਂ ਡਰਾਇੰਗ ਦੇ ਨਾਲ ਨਾਲ ਭੰਗੜਾ ਅਤੇ ਰਿਲੇ ਦੌੜ ਵਿੱਚ ਵੀ ਬਹੁਤ ਵਧੀਆ ਸੀ ਭੰਗੜੇ ਨਾਲ ਮੈਨੂੰ ਮਾਨਸਿਕ ਰੋਗ ਤੋਂ ਮੁਕਤੀ ਮਿਲਦੀ ਸੀ ਭੰਗੜਾ ਮੈਨੂੰ ਬਹੁਤ ਹੀ ਵਧੀਆ ਲੱਗਦਾ ਸੀ ਜਿਸ ਜਿਸ ਨੂੰ ਪਾਉਣ ਨਾਲ ਮੈਂ ਆਪਣੇ ਆਪ ਨੂੰ ਵਧੀਆ ਮਹਿਸੂਸ ਕਰਦਾ ਸੀ ਭੰਗੜਾ ਮੈਨੂੰ ਬਹੁਤ ਬਹੁਤ ਹੀ ਵਧੀਆ ਮਹਿਸੂਸ ਕਰਾਉਂਦਾ ਸੀ ਭੰਗੜਾ ਅਸੀਂ ਡਿਸਟਰਿਕ ਲੈਵਲ ਤੱਕ ਵੀ ਭੰਗੜਾ ਕਰਨ ਗਏ ਮੈਂ ਆਪਣੇ ਸਾਥੀਆਂ ਨਾਲ ਬਹੁਤ ਮੌਜਾਂ ਕੀਤੀਆਂ ਭੰਗੜੇ ਵਿੱਚ ਸਾਡਾ ਭੰਗੜੇ ਦਾ ਪ ਭੰਗੜੇ ਦੇ ਕੋਚ ਦਾ ਨਾਂ ਮੋਹਨਦੀਪ ਸਿੰਘ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਭੰਗੜੇ ਕਿਵੇਂ ਪਾਈਦਾ ਹੈ ਭੰਗੜੇ ਦੇ ਕਿੰਨੇ ਪ੍ਰਕਾਰ ਹਨ ਵੱਖ ਵੱਖ ਤਰ੍ਹਾਂ ਦੀਆਂ ਭੰਗੜੇ ਦੀਆਂ ਕਿਸਮਾਂ ਉਹਨਾਂ ਨੇ ਸਾਨੂੰ ਦੱਸੀਆਂ ਅਸੀਂ ਕਈ ਤਰ੍ਹਾਂ ਦਾ ਭੰਗੜਾ ਬਹੁਤ ਹੀ ਸਕੂਲਾਂ ਵਿੱਚ ਪ੍ਰਦਰਸ਼ਨ ਕਰਨ ਗਏ ਭੰਗੜਾ ਪਾਉਂਦਿਆ ਸਮੇਂ ਕਈ ਵਾਰੀ ਤਾਂ ਮੇਰੀ ਪੈਰ ਵਿੱਚ ਮੋਚ ਵੀ ਆ ਜਾਂਦੀ ਸੀ ਪਰ ਮੈਨੂੰ ਡਰ ਮੈਨੂੰ ਜਦੋਂ ਮੈਂ ਭੰਗੜਾ ਕਰਦਾ ਸੀ ਤਾਂ ਮੈਨੂੰ ਬਹੁਤ ਵਧੀਆ ਮਹਿਸੂਸ ਹੁੰਦਾ ਸੀ ਤਾਂ ਕਰਕੇ ਮੈਂ ਉਸ ਮੋਚ ਨੂੰ ਮਹਿਸੂਸ ਨਹੀਂ ਕਰਦਾ ਸੀ ਕਿ ਮੇਰੇ ਪੈਰ ਨੂੰ ਮੋਚ ਆਈ ਆ ਜਾਂ ਕਿਸ ਤਰ੍ਹਾਂ ਭੰਗੜੇ ਕਰਨ ਨਾਲ ਮੈਂ ਆਪਣਾ ਸ ਸਰੀਰ ਦਾ ਰੋਗ ਮੁਕਤ ਰਹਿਣਾ ਸੀ ਭੰਗੜੇ ਕਰਨ ਨਾਲ ਮੇਰੀਆਂ ਸਾਰੇ ਮਸਲੇ ਮਾਸਪੇਸ਼ੀਆਂ ਨੂੰ ਮਜ ਮਜ਼ਬੂਤੀ ਮਿਲਦੀ ਸੀ ਭੰਗੜਾ ਬਹੁਤ ਹੀ ਵਧੀਆ ਸੀ ਮੈਂ ਆਪਣੇ ਸਾਥੀਆਂ ਨਾਲ ਕਈ ਵਾਰੀ ਕਈ ਮੈਚ ਅਸੀਂ ਜਿੱਤੇ ਵੀ ਭੰਗੜੇ ਵਿੱਚ ਕਈ ਵਾਰੀ ਅਸੀਂ ਹਾਰੇ ਵੀ ਹਾਂ ਪਰ ਅਸੀਂ ਜਦੋਂ ਸਾਡਾ ਕੋਚ ਸਾਨੂੰ ਕਹਿ ਦਿੰਦਾ ਸੀ ਭੰਗੜਾ ਪਾਉਣਾ ਲ ਤਾਂ ਅਸੀਂ ਹੱਸ ਕੇ ਭੰਗੜਾ ਪਾਉਂਦੇ ਸੀ ਭੰਗੜੇ